ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਪਰ ਸਭ ਤੋਂ ਵਧੀਆ ਕਿਤਾਬ ਮੈਨੂੰ ਪੂਰਨ ਸਿੰਘ ਦੁਆਰਾ ਲਿਖੀ ਗਈ ਦਸ ਗੁਰੂ ਸਾਹਿਬਾਨ ਵਾਲੀ ਕਿਤਾਬ ਬਹੁਤ ਹੀ ਵਧੀਆ ਲੱਗਦੀ ਹੈ ਉਸ ਵਿੱਚ ਸਾਡੇ ਸਿੱਖ ਧਰਮ ਬਾਰੇ ਦੱਸਿਆ ਗਿਆ ਹੈ ਸਿੱਖ ਧਰਮ ਬਾਰੇ ਦੱਸਿਆ ਗਿਆ ਹੈ ਇਹ ਕਿਤਾਬ ਅਨੁਵਾਦ ਭਾਸ਼ਾਵਾਂ ਵਿੱਚ ਉਪਲੱਬਧ ਕੀਤੀ ਗਈ ਹੈ ਇਸ ਨੂੰ ਇੰਗਲਿਸ਼ ਵਿੱਚ ਟੈੱਨ ਮਾਸਟਰ ਟੈੱਨ ਮਾਸਟਰ ਬੁੱਕ ਕਿਹਾ ਜਾਂਦਾ ਹੈ ਇਸ ਵਿੱਚ ਸਿੱਖ ਧਰਮ ਦੀ ਇੱਕ ਇੱਕ ਇੱਕ ਇੱਕ ਸਥਿਤੀ ਨੂੰ ਦਰਸਾਇਆ ਗਿਆ ਹੈ ਇਸ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੇ ਹਿਸਟਰੀ ਦੱਸੀ ਗਈ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਸਾਹਿਬਾਨ ਨੇ ਕਿਸ ਤਰ੍ਹਾਂ ਇਸਤਰੀਆਂ ਦੀ ਰੱਖਿਆ ਲਈ ਇਸਤਰੀਆਂ ਦੀ ਰੱਖਿਆ ਲਈ ਰ ਰੱਖਿਆ ਲਈ ਕਦਮ ਚੁੱਕੇ ਕਦਮ ਚੁੱਕੇ ਇਸ ਵਿੱਚ ਦਸ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਪੂਰੇ ਪਰਿਵਾਰ ਦਾ ਜ਼ਿਕਰ ਕੀਤਾ ਗਿਆ ਹੈ ਕਿ ਉ ਇਹਨਾਂ ਇਹਨਾਂ ਦੇ ਪਰਿਵਾਰ ਉੱਪਰ ਕਿਸ ਤਰ੍ਹਾਂ ਕੁਰਬਾਨੀਆਂ ਹੋਈਆਂ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਇਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਇਸ ਕਿਤਾਬ ਨੂੰ ਦੇਖਦੇ ਹੋਏ ਕਈ ਫਿਲਮਾਂ ਵੀ ਤਿਆਰ ਕੀਤੀਆਂ ਗਈਆਂ ਜਿਵੇਂ ਕਿ ਚਾਰ ਸਾਹਿਬਜ਼ਾਦੇ ਭਾਈ ਤਾਰੂ ਸਿੰਘ ਆਦਿ ਫਿਲਮਾਂ ਵੀ ਤਿਆਰ ਕੀਤੀਆਂ ਗਈਆਂ ਹਨ ਇਸ ਕਿਤਾਬ ਨੂੰ ਮੈਂ ਵਾਰ ਵਾਰ ਪੜ੍ਹਦੀ ਹਾਂ ਕਿਉਂਕਿ ਇਹ ਕਿਤਾਬ ਪੜ੍ਹ ਕੇ ਮੈਨੂੰ ਸਕੂਨ ਮਿਲਦਾ ਹੈ ਅਤੇ ਇਸ ਕਿਤਾਬ ਪੜ੍ਹਨ ਨਾਲ਼ ਮੈਨੂੰ ਸਿੱਖ ਧਰਮ ਦੇ ਇਤਿਹਾਸ ਦਾ ਪਤਾ ਲੱਗਦਾ ਹੈ